ਹੈਲੋ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਭਾਜੀ ਗੁਰਕੰਵਲ ਟੂਰਿਸਟ ਬੋਲਦੇ ਓ ਹਾਂਜੀ ਭਾਜੀ ਮੈਂ ਨਾ ਐਕਚੁਲੀ ਮੈਨੂੰ ਆਪਣੇ ਫਰੈਂਡ ਤੋਂ ਤੁਹਾਡਾ ਨੰਬਰ ਮਿਲਿਆ ਸੀਗਾ ਕਿ ਇਹ ਵਧੀਆ ਗਾਈਡੈਂਸ ਕਰਦੇ ਹੈ ਵੀ ਤੁਸੀਂ ਇਹਨਾਂ ਨਾਲ ਘੁੰਮਣ ਚਲੇ ਜਿਓ ਅਸੀਂ ਨਾ ਪੂਰੀ ਫੈਮਲੀ ਨੇ ਇੱਦਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣਾ ਹੈ ਅਤੇ ਤੁਸੀਂ ਸਾਨੂੰ ਗਾਈਡ ਕਰ ਸਕਦੇ ਓ ਠੀਕ ਹੈ ਭਾਜੀ ਠੀਕ ਹੈ ਭਾਜੀ ਅਤੇ ਭਾਜੀ ਆਪਣੀ ਕੋਸਟ ਕਿੰਨੀ ਆਉਗੀ ਅਸੀਂ ਚਾਰ ਜਾਣੇ ਹਾਂ ਹਾਂਜੀ ਤਿੰਨ ਦਿਨ ਰਹਿਣਾ ਭਾਜੀ ਅਸੀਂ ਹਾਂ ਹਾਂਜੀ ਹਾਂਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਹਾਂਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਭਾਜੀ ਹਾਂਜੀ ਭਾਜੀ ਅਸੀਂ ਜਿੱਦਾਂ ਹੁਣ ਬਾਹਰ ਤੋਂ ਆਉਣਾ ਹੈ ਭਾਜੀ ਫਿਰ ਅਸੀਂ ਆ ਕੇ ਸਭ ਤੋਂ ਪਹਿਲਾਂ ਓੱਥੇ ਹੀ ਜਾਣਾ ਪਸੰਦ ਕਰਾਂਗੇ ਆਪਣੇ ਪੂਰੇ ਪਰਿਵਾਰ ਨਾਲ ਅਤੇ ਅਸੀਂ ਜਿਸ ਦਿਨ ਜਾਣਾ ਹੋਇਆ ਤੁਹਾਨੂੰ ਦੱਸ ਦੇਊਂਗੇ ਤੁਸੀਂ ਸਾਨੂੰ ਦੱਸ ਦਿਓ ਵੀ ਸਾਨੂੰ ਕਿਆ ਕਿਆ ਡੋਕੂਮੈਂਟ ਲੱਗੁਗੇ ਓੱਥੇ ਜਾਣ ਵਾਸਤੇ ਕਿਆ ਕਿਆ ਚੀਜ਼ਾਂ ਚਾਹੀਦੀਆਂ ਹੋਊਗੀਆਂ ਹਾਂਜੀ ਹਾਂਜੀ ਭਾਜੀ ਸਾਰੇ ਮੇਨ ਪਰੂਫ ਵੀ ਪਏ ਹੈ ਸਾਡੇ ਕੋਲ ਬਾਹਰ ਦੇ ਪਰੂਫ ਵੀ ਪਏ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭਾਜੀ ਕ ਅ ਪੇਮੈਂਟ ਦਾ ਕੋਈ ਚੱਕਰ ਨਹੀਂ ਹੈਗਾ ਭਾਜੀ ਹੋਰ ਹੋਰ ਕੋਈ ਸਾਨੂੰ ਚੀਜ਼ ਨਾਲ ਲੈ ਕੇ ਜਾਣੀ ਪਵੇ ਜਿਹਦੀ ਜ਼ਰੂਰਤ ਪੈ ਆਪਾਂ ਜਾਵਾਂਗੇ ਕਿਵੇਂ ਅਸੀਂ ਅੰਮ੍ਰਿਤਸਰ ਤੋਂ ਫਿਰ ਸਿੱਧਾ ਪਾਕਿਸਤਾਨ ਬੋਡਰ 'ਤੇ ਜਾਵਾਂਗੇ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭਾਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਠੀਕ ਹੈ ਭਾਜੀ ਓਕੇ ਥੈਂਕ ਯੂ ਜੀ ਓਕੇ